ਮੇਰਾ ਦੋਸਤ ਆ ਇੱਕ ਜਿਹੜਾ ਕਿ ਬਾਹਰ ਰਹਿੰਦਾ ਹੈ ਉਹਦਾ ਇੱਕ ਕੋਈ ਉਸ ਉਸ ਦੇ ਨਾਲ ਮੈਨੂੰ ਕੰਮ ਪੈ ਗਿਆ ਅਤੇ ਉਹਨੂੰ ਮੈਂ ਮਿਲ ਵੀ ਨਹੀਂ ਸਕਦਾ ਸੀਗਾ ਕਿਉਂਕਿ ਟਾਈਮ ਬਹੁਤ ਘੱਟ ਸੀਗਾ ਓਨੇ ਚਿਰ 'ਚ ਨਾ ਮੈਂ ਉੱਥੇ ਪਹੁੰਚ ਸਕਦਾ ਸੀ ਅਤੇ ਉਹਨੇ ਮੇਰੇ ਦੋਸਤ ਨੇ ਕੀ ਕੀਤਾ ਕਿ ਔਨਲਾਈਨ ਲੈ ਕੇ ਉਦੋਂ ਬਾਅਦ ਜੋ ਰਿਕੁਾਇਰਮੈਂਟ ਸੀਗੀ ਉਹ ਪੂਰੀ ਕਰਤੀ ਇਹਦੇ ਨਾਲ ਸਾਡਾ ਟਾਈਮ ਵੀ ਬਚ ਗਿਆ ਅਤੇ ਕੰਮ ਵੀ ਹੋ ਗਿਆ ਅੱਜ ਕੱਲ ਔਨਲਾਈਨ ਜਾਂ ਕੰਪਿਊਟਰ 'ਤੇ ਕੰਮ ਕਰਨ ਦਾ ਇਹੀ ਫਾਇਦਾ ਹੈ ਕਿ ਆਪਣਾ ਟਾਈਮ ਆਉਣ ਜਾਣ ਦਾ ਕਾਫੀ ਬਚ ਜਾਂਦਾ ਹੈ